ਯੋਗ ਯੋਗ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਹ ਵਿਅਕਤੀ ਨੂੰ ਸਿਹਤਮੰਦ ਰੱਖਦਾ ਅਤੇ ਤਨਾਵ ਥਕਾਵਟ ਅਤੇ ਭਾਰ ਘਟਾਨਾ ਤੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਅਤੇ ਨੀਂਦ ਘੱਟ ਆਉਣੀ ਅਤੇ ਵਧੇਰੇ ਮਾਨਸਿਕ ਤਨਾਵ ਸ਼ਾਮਲ ਦੂਰ ਰਹਿੰਦਾ ਤਾਂ ਇਸ ਤਰ੍ਹਾਂ ਹੀ ਮਾਨਸਿਕ ਸਰੀਰ ਲਈ ਯੋਗ ਬਹੁਤ ਹੀ ਲਾਭਦਾਇਕ ਹੈ ਹਰ ਇਕ ਇਨਸਾਨ ਨੂੰ ਯੋਗ ਕਰਨਾ ਚਾਹੀਦਾ ਜਿਹੜੇ ਵਿਅਕਤੀ ਪਹਿਲੀ ਵਾਰ ਯੋਗ ਕਰਦਾ ਹੈ ਉਸਨੂੰ ਸਿੰਪਲ ਜੀਆਂ ਜਿਵੇਂ ਕਿ ਸਿਰਫ ਆਸਨ ਕਰਨਾ ਚਾਹੀਦਾ ਹੈ ਜੋ ਆਸਨ ਹੋ ਗਿਆ ਜਿਵੇਂ ਕਿ ਉਹ ਕਰਨਾ ਚਾਹੀਦਾ ਤਾਂ ਕਿ ਆਪਾਂ ਹੌਲੀ ਹੌਲੀ ਬੰਦਾ ਅੱਗੇ ਅੱਗੇ ਵੱਧਦਾ ਤਾਂ ਸਵੇਰ ਦੀ ਸੈਰ ਕਰਨੀ ਵਿਅਕਤੀ ਨੂੰ ਖਾਣ ਪੀਣ ਦਾ ਧਿਆਨ ਅਤੇ ਤੰਦਰੁਸਤੀ ਲਈ ਰੋਜ ਸੈਰ ਕਰਨੀ ਚਾਹੀਦੀ ਹੈ ਅਤੇ ਯੋਗ ਹਮੇਸ਼ਾ ਹੀ ਵਿਅਕਤੀ ਨੂੰ ਤੰਦਰੁਸਤ ਬਣਾ ਕੇ ਰੱਖਦਾ ਹੈ ਸ਼ੀਸ਼ ਆਸਣ ਕਰਨਾ ਚਾਹੀਦਾ ਹੈ ਤਾੜ ਆਸਨ ਇਦਾਂ ਦੇ ਆਸਨ ਕਰਨੇ ਚਾਹੀਦੇ ਆ ਜੋ ਕਿ ਵਿਅਕਤੀ ਨੂੰ ਹਮੇਸ਼ਾ ਤੰਦਰੁਸਤ ਅਤੇ ਹੈਲਥੀ ਰੱਖਣ ਦੇ ਵਿੱਚ ਮਦਦ ਕਰਦੇ ਹਨ ਅਤੇ ਯੋਗ ਹਮਾਰੇ ਹਰ ਇੱਕ ਵਿਅਕਤੀ ਲਈ ਬਹੁਤ ਹੀ ਜ਼ਰੂਰੀ ਹੈ